ਅੱਜ ਕੱਲ੍ਹ ਖੇਡਾਂ ਨੂੰ ਟੈਲੀਵਿਜ਼ਨਾਂ ਅਤੇ ਫੋਨਾਂ ਰਾਹੀਂ ਵੀ ਬਹੁਤ ਦੇਖਿਆ ਜਾ ਸਕਦਾ ਹੈ ਜਿਸ ਕਰਕੇ ਖੇਡਾਂ ਵੀ ਮੰਨੋਰੰਜਨ ਦਾ ਇੱਕ ਸੂਤਰ ਬਣ ਚੁੱਕੀਆਂ ਹਨ ਖੇਡਾਂ ਨੂੰ ਦੇਖਣ ਵਾਲੇ ਵੀ ਬਹੁਤ ਲੋਕ ਹਨ ਜੋ ਕਿ ਇਸ ਦੇ ਪੱਕੇ ਦਰਸ਼ਕ ਬਣ ਚੁੱਕੇ ਹਨ ਖੇਡਾਂ ਨੂੰ ਪਸੰਦ ਕਰਨ ਵਾਲੇ ਲੋਕ ਵੀ ਟੀਵੀਆਂ'ਤੇ ਅਤੇ ਫੋਨਾਂ 'ਤੇ ਇਹਨਾਂ ਖੇਡਾਂ ਨੂੰ ਦੇਖਦੇ ਹਨ ਜਿਸ ਕਰਕੇ ਇਹਨਾਂ ਦੇ ਕੱਟਰ ਫੈਨ ਵੀ ਬਣ ਜਾਂਦੇ ਹਨ ਅਤੇ ਅੱਗੇ ਇਹ ਆਪਣੇ ਓਪੋਨੈਂਟ ਟੀਮਾਂ ਨੂੰ ਟਾਰਗੇਟ ਕਰਦੇ ਹੋਏ ਬਹੁਤ ਮਖੌਲ ਵੀ ਕਰਦੇ ਹਨ ਅਤੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਅਗਲਿਆਂ ਨੂੰ ਦਿਖਾਉਂਦੇ ਵੀ ਹਨ ਕ੍ਰਿਕਟ ਨੂੰ ਦੇਖਿਆ ਜਾਵੇ ਤਾਂ ਪੂਰੇ ਅੰਤਰਰਾਸ਼ਟਰੀ ਸਤਰ 'ਤੇ ਬਹੁਤ ਉੱਚੇ ਦਰਜੇ 'ਤੇ ਮੰਨਿਆ ਜਾਂਦਾ ਹੈ ਕਿਉਂਕਿ ਵਰਲਡ ਕੱਪ ਵਿੱਚ ਵੀ ਭਾਰਤ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਦਸ ਮੈਚ ਜਿੱਤ ਕੇ ਇੱਕ ਵਧੀਆ ਜਿੱਤ ਪ੍ਰਾਪਤ ਕੀਤੀ ਜਿਸ ਕਾਰਨ ਅੱਜ ਕੱਲ੍ਹ ਖੇਡਾਂ ਵਿੱਚ ਬਹੁਤ ਜ਼ਿਆਦਾ ਧਿਆਨ ਦੇਣ ਦਿੱਤਾ ਜਾਂਦਾ ਹੈ ਅਤੇ ਖੇ ਖੇਡਾਂ ਨੂੰ ਪਸੰਦ ਕਰਨ ਵਾਲੇ ਲੋਕ ਹਮੇਸ਼ਾ ਹੀ ਆਪਣੇ ਮਨਪਸੰਦ ਖਿਡਾਰੀਆਂ ਨੂੰ ਦੇਖਣਾ ਵੀ ਬਹੁਤ ਪਸੰਦ ਕਰਦੇ ਹਨ